ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਛਾ ਜੀ ਠੀਕ ਹੈ ਜੀ ਜੀ ਆਇਆਂ ਨੂੰ ਜੀ ਮਾਘੀ ਦਾ ਮੇਲਾ ਜੀ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਬਹੁਤ ਹੀ ਪੁਰਾਣਾ ਇਤਿਹਾਸਿਕ ਮੇਲਾ ਅਤੇ ਇ ਇਹ ਇੱਥੇ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਇਸ ਦੇ ਵਿੱਚ ਸਭ ਤੋਂ ਪਹਿਲਾਂ ਮਾਘੀ ਮੇਲੇ ਦੇ ਦਿਨ ਲੋਕ ਸੁਬਾਹ ਉੱਠਦੇ ਹੈ ਜੀ ਇੱਕ ਵੱਜਦੇ ਤੋਂ ਇਸ਼ਨਾਨ ਕਰਨਾ ਵੱਡਾ ਗੁਰਦੁਆਰਾ ਸਾਹਿਬ ਜਾਂਦੇ ਹੈ ਅਤੇ ਇਸ਼ਨਾਨ ਕਰਦੇ ਹੈ ਜੀ ਅਤੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਵਿੱਚ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕ ਕੇ ਅਤੇ ਉਸ ਤੋਂ ਬਾਅਦ ਆ ਕੇ ਸਾਡੇ ਆਪਣੇ ਇੱਥੇ ਮੁਕਤਸਰ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਲੰਗਰ ਲਾਏ ਜਾਂਦੇ ਹੈ ਜੀ ਸੁਬਾਹ ਦੇ ਟੈਮ ਚਾਹ ਦਾ ਲੰਗਰ ਬਰੈੱਡ ਪਕੌੜਿਆਂ ਦੇ ਲੰਗਰ ਸੰਗਤ ਵਾਸਤੇ ਲਾਏ ਜਾਂਦੇ ਹੈ ਜੀ ਜਿਹੜੀ ਬਾਹਰੋਂ ਸੰਗਤ ਆਉਂਦੀ ਹੈ ਜੀ ਉਨ੍ਹਾਂ ਵਾਸਤੇ ਲੰਗਰ ਦਾ ਬਹੁਤ ਖ਼ਾਸ ਪ੍ਰਬੰਧ ਹੁੰਦਾ ਉੱਥੋਂ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕ ਕੇ ਬਾਹਰ ਆ ਕੇ ਸੰਗਤ ਚਾਹ ਪਾਣੀ ਛੱਕਦੀ ਹੈ ਔਰ ਸਾਰੇ ਗੁਰਦੁਆਰਿਆਂ ਦੇ ਵਿੱਚ ਮੱਥਾ ਟੇਕਣ ਜਾਂਦੇ ਹੈ ਗੁਰਦੁਆਰੇ 'ਚ ਆਪਣੇ ਮੁਕਤਸਰ ਸਾਹਿਬ ਦੇ ਵਿੱਚ ਟਿੱਬੀ ਸਾਹਿਬ ਰੋਡ 'ਤੇ ਦਾਤਣ ਸਾਹਿਬ ਗੁਰਦੁਆਰਾ ਬਹੁਤ ਮਸ਼ਹੂਰ ਹੈ ਜੀ ਅਤੇ ਉਸ ਤੋਂ ਬਾਅਦ ਇੱਥੇ ਬੱਚਿਆਂ ਵਾਸਤੇ ਝੂਲੇ ਵਗੈਰਾ ਬਹੁਤ ਲਾਏ ਜਾਂਦੇ ਹੈ ਆਮ ਲੇਡੀਜ਼ ਵਾਸਤੇ ਜੋ ਘੁੰਮਣ ਆਉਂਦੀਆਂ ਹੈ ਪਿੰਡਾਂ ਦੇ ਵਿੱਚੋਂ ਟਰਾਲੀਆਂ ਭਰ ਭਰ ਕੇ ਸੰਗਤ ਆਉਂਦੀ ਹੈ ਜੀ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਨਮਸਕਾਰ ਕਰਨ ਤੋਂ ਬਾਅਦ ਲੇਡੀਜ ਬੱਚੇ ਸਾਰੇ ਖੂਬ ਇੰਜੋਆਏ ਕਰਦੇ ਹੈ ਆਪਣਾ ਬੱਚਿਆਂ ਵਾਸਤੇ ਝੂਲੇ ਖਿਡੌਣੇ ਬਹੁਤ ਮਤਲਬ ਕਿ ਲੱਗਦੇ ਹੈ ਜੀ ਬੱਚੇ ਖਰੀਦਦੇ ਹੈਗੇ ਹੈ ਅਤੇ ਬਾਹਰੋਂ ਜਿਵੇਂ ਉਹ ਕਹਿ ਦਿੰਦੇ ਹੈ ਵੀ ਚੰਡੋਲਾਂ ਦਾ ਦੀਆਂ ਉਨ੍ਹਾਂ ਦੇ ਬੱਚੇ ਬਹੁਤ ਅਨੰਦ ਮਾਣਦੇ ਸਾਰੇ ਹੀ ਵੱਡੇ ਛੋਟੇ ਸਾਰੇ ਬੈਠ ਜਾਂਦੇ ਜੀ ਉਹਦੇ 'ਤੇ ਅਤੇ ਹੋਰ ਵੀ ਇੱਥੇ ਬਹੁਤ ਮਤਲਬ ਰੋਮਾਂਚਕ ਚੀਜ਼ਾਂ ਝੂਲੇ ਲਾਏ ਜਾਂਦੇ ਹੈ ਜਿਨ੍ਹਾਂ ਦੇ ਉੱਤੇ ਬੱਚੇ ਕਈ ਤਰ੍ਹਾਂ ਬੈਠ ਕੇ ਜੀ ਉੱਪਰ ਹੇਠਾਂ ਜਾਂਦੀਆਂ ਚੰਡੋਲਾਂ ਲੱਗਦੀਆਂ ਜਿਹੜੀਆਂ ਘੁੰਮਣ ਵਾਲੇ ਛੋਟੇ ਬੱਚੇ ਹੁੰਦੇ ਜਿਹੜੇ ਚਾਰ ਪੰਜ ਸਾਲ ਦੇ ਬੱਚੇ ਉੱਪਰ ਨਹੀਂ ਚੜ੍ਹਦੇ ਉਨ੍ਹਾਂ ਨੂੰ ਐਂ ਘੇਰੇ ਲੋਟ ਗੋਲ ਲੱਗੇ ਹੁੰਦੇ ਹੈ ਜੀ ਮਤਲਬ ਕਿ ਚੰਡੋਲਾਂ ਲਾਈਆਂ ਜਾਂਦੀਆਂ ਉਨ੍ਹਾਂ 'ਤੇ ਬੈਠ ਕੇ ਝੂਟੇ ਦਿੱਤੇ ਜਾਂਦੇ ਹੈ ਹਾਂਜੀ ਅਤੇ ਇੱਥੇ ਆਪਣੇ ਬਠਿੰਡਾ ਰੋਡ 'ਤੇ ਦੋ ਗੁਰਦੁਆਰੇ ਬਹੁਤ ਮਸ਼ਹੂਰ ਹੈ ਜੀ ਤਰਨਤਾਰਨ ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਇੱਥੇ ਇਹ ਵੀ ਆਉਂਦੇ ਹੈ ਜੀ ਹਾਂਜੀ ਇੱਥੇ ਇੱਕ ਮੋ ਇੱਥੇ ਸਰਕਸ ਲੱਗਦੀ ਹੈ ਜੀ ਬਹੁਤ ਮਸ਼ਹੂਰ ਹੁੰਦੀ ਹੈ ਸਰਕਸ ਦਾ ਨਾਮ ਆਮ ਮੇਲੇ ਦੇ ਵਿੱਚ ਬਹੁਤ ਮਸ਼ਹੂਰ ਕੀਤੀ ਜਾਂਦੀ ਹੈ ਅਤੇ ਉਸਦੇ ਵਿੱਚ ਇੱਕ ਮੌਤ ਦਾ ਖੂਹ ਮੌਤ ਦਾ ਖੂਹ ਸਰਕਸ ਦਾ ਸੀਨ ਹੁੰਦਾ ਜੀ ਉਸ ਦੇ ਵਿੱਚ ਬਹੁਤ ਮਤਲਬ ਲੋਕ ਹਾਂਜੀ ਬਹੁਤ ਲੋਕ ਉਸਦੇ ਵਿੱਚ ਬੈਠ ਕੇ ਉਹਦਾ ਉਹਦਾ ਵੀ ਬੜਾ ਅਨੰਦ ਮਾਣਦੇ ਹੈ ਜੀ ਹਾਂਜੀ ਅਤੇ ਹੋਰ ਵੀ ਬਹੁਤ ਜ਼ਿਆਦਾ ਮਤਲਬ ਕਿ ਇੱਥੇ ਇਤਿਹਾਸਿਕ ਥਾਂ ਬਣੀ ਹੋਈ ਹੈ ਬਹੁਤ ਮਤਲਬ ਹੋਰ ਹਾਂਜੀ ਅਤੇ ਹਾਂਜੀ ਬਸ ਕੋਈ ਨਹੀਂ ਜੀ ਵੇਖੋ ਤੁਸੀਂ ਸਾਰੇ ਆਪਣੇ ਇੱਧਰ ਸਾਰੇ ਗੁਰਦੁਆਰਿਆਂ ਦੇ ਵਿੱਚ ਘੁੰਮੋ ਅਨੰਦ ਮਾਣੋ ਠੀਕ ਹੈ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ